ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਨ ਗੱਲ ਕਰ ਰਿਹਾ ਹਾਂ ਮੈਂ ਤੁਹਾਡੀ ਵੈਬਸਾਈਟ ਤੋਂ ਇੱਕ ਆਈਫ਼ੋਨ ਥਰਟੀਨ ਮੰਗਵਾਇਆ ਸੀ ਜਿਸ ਦੀ ਡਿਲੀਵਰੀ ਬਹੁਤ ਲੇਟ ਹੋਈ ਹੈ ਮੈਂ ਇੱਕ ਅਗਸਤ ਨੂੰ ਆਰਡਰ ਪਾਇਆ ਸੀ ਅੱਜ ਮੈਨੂੰ ਤੀਹ ਤਰੀਕ ਨੂੰ ਤੁਹਾਡਾ ਆਰਡਰ ਮਿਲਿਆ ਬਟ ਜਦ ਮੈਂ ਉਸਨੂੰ ਖੋਲ੍ਹਿਆ ਤਾਂ ਮੈਂ ਕਲਰ ਬਲੂ ਮੰਗਵਾਇਆ ਸੀ ਪਰ ਉਹ ਕਲਰ ਬਲੈਕ ਨਿਕਲਿਆ ਪਲੱਸ ਉਸਦੇ ਹਾਰਡਵੇਅਰ 'ਚ ਵੀ ਪ੍ਰੋਬਲਮ ਸੀ ਜਿੱਦਾਂ ਉਹਦਾ ਕੈਮਰਾ ਜਦ ਮੈਂ ਉਪਨ ਕਰਦਾ ਉਪਨ ਕਰਦੇ ਹੀ ਉਹਦਾ ਕੈਮਰਾ ਡਰੋਪ ਹੋ ਜਾਂਦਾ ਸੀ ਅਤੇ ਸਪੀਕਰ ਵੀ ਪ੍ਰੋਪਰਲੀ ਵਰਕ ਨਹੀਂ ਕਰ ਰਿਹਾ ਇੱਕ ਸਪੀਕਰ ਵਰਕ ਕਰ ਰਿਹਾ ਦੂਜਾ ਨਹੀਂ ਚੱਲ ਰਿਹਾ ਅਤੇ ਜਦੋਂ ਮੈਂ ਉਹਦੇ 'ਚ ਸਿਮ ਇਨਸਰਟ ਕੀਤੀ ਉਹਦੇ 'ਚ ਨੈਟਵਰਕ ਇਸ਼ੂ ਵੀ ਨੇ ਅਤੇ ਲੈਗ ਇਸ਼ੂ ਵੀ ਹੈ ਕਿਰਪਾ ਕਰਕੇ ਜਾਂ ਤਾਂ ਮੇਰੇ ਪੈਸੇ ਰਿਫੰਡ ਕੀਤੇ ਜਾਣ ਜਾਂ ਮੇਰਾ ਆਰਡਰ ਦੁਬਾਰਾ ਪਲੇਸ ਕੀਤਾ ਜਾਵੇ ਧੰਨਵਾਦ